ਟਰੇਨ ਉੱਤੇ ਤੁਹਾਡੇ ਨਾਲ ਹੋਣ ਵਾਲੇ ਬਾਈਕਿੰਗ ਗੇਅਰ ਜਾਂ ਸਾਜੋ ਸਮਾਨ ਦਿਓ ਕੁੱਝ ਸੱਭ ਤੋਂ ਮਹੱਤਵਪੂਰਨ ਟੋਪ ਦੇ ਵਿੱਚ ਸ਼ਾਮਿਲ ਹਨ ਹੈਲਮਟ ਸਾਈਕਲ ਚਲਾਉਂਦੇ ਸਮੇਂ ਸੁਰੱਖਿਆ ਲਈ ਸਹੀ ਢੰਗ ਨਾਲ ਫਿੱਟ ਹੈਲਮੇਟ ਜ਼ਰੂਰੀ ਹੈ ਦੁਰਘਟਨਾਵਾਂ ਜਾਂ ਡਿੱਗਣ ਸਥਿਤੀ ਵਿੱਚ ਸਿਰ ਦੀਆਂ ਸੱਟਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਮੁਰੰਮਤ ਕਿੱਟ ਇੱਕ ਬੁਨਿਆਦੀ ਮੁਰੰਮਤ ਕਿੱਟ ਵਿੱਚ ਵਾਧੂ ਅੰਦਰੂਨੀ ਟਿਊਬਾਂ ਟਾਇਰ ਲੀਵਰ ਐਲਨ ਕੁੰਜੀਆਂ ਅਤੇ ਸਕਰਿਊ ਡਰਾਈਵਰਾਂ ਵਾਲਾ ਇੱਕ ਮਲਟੀ ਟੂਲ ਪੈਚ ਕਿੱਟਾਂ ਅਤੇ ਇੱਕ ਮਿੰਨੀ ਪੰਪ ਜਾਂ ਸੀਲ ਟੂਲ ਵਰਗੀਆਂ ਚੀਜ਼ਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਫਲੈਟ ਟਾਇਰਾਂ ਦੀ ਐਡਜਸਟਮੈਂਟ ਆ ਵਰਗੇ ਮਕੈਨੀਕਲ ਮੁੱਦਿਆਂ ਨੂੰ ਸੰਭਾਲਣ ਲਈ ਸੜਕ ਪਾਣੀ ਅਤੇ ਹਾਈਡਰੇਸ਼ਨ ਸਾਈਕਲਿੰਗ ਦੌਰਾਨ ਹਾਈਡਰੇਟਿਡ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਤਰਲ ਪਦਾਰਥ ਨੂੰ ਭਰਨ ਲਈ ਪਾਣੀ ਦੀ ਬੋਤਲ ਜਾਂ ਹਾਈਡਰੇਸ਼ਨ ਪੈਕ ਲੈ ਕੇ ਜਾਣਾ ਮਹੱਤਵਪੂਰਨ ਹੈ ਖਾਸ ਕਰਕੇ ਲੰਬੀਆਂ ਸਵਾਰੀਆਂ ਜਾਂ ਗਰਮ ਮੌਸਮ ਵਿੱਚ ਸਨੈਕ ਇੱਥੇ ਮੋਸ਼ਨ ਐਨਰਜੀ ਬਾਹਰ ਜੈਲ ਜਾਂ ਹੋਰ ਸਨੈਕਸ ਲੰਬੇ ਸਫਰ ਦੌਰਾਨ ਧੀਰਜ ਨੂੰ ਕਾਇਮ ਰੱਖਣ ਅਤੇ ਥਕਾਣ ਨੂੰ ਰੋਕਣ ਲਈ ਊਰਜਾ ਦੇ ਅਤੇ ਸਰੋਤ ਪ੍ਰਧਾਨ ਕਰਦੇ ਹਨ ਢੁੱਕਵੇਂ ਕੱਪੜੇ ਸਾਈਕਲਿੰਗ ਲਈ ਢੁਕਵੇਂ ਕੱਪੜੇ ਪਾਉਣੇ ਜਿਸ ਵਿੱਚ ਨਮੀਂ ਨੂੰ ਮਿਟਾਉਣ ਵਾਲੇ ਕੱਪੜੇ ਪੈਟ ਸ਼ਰਟਸ ਅਤੇ ਪਰਿਵਰਤਨਸ਼ੀਲ ਮੌਸਮ ਦੀਆਂ ਵਸਤਾਂ ਸ਼ਾਮਿਲ ਹਨ ਤੱਤਾਂ ਤੂੰ ਆਰਾਮ ਅਤੇ ਸੁਰੱਖਿਆ ਦੇ ਯਕੀਨੀ ਬਣਾਉਂਦਾ ਹੈ ਨੈਵੀਗੇਸ਼ਨ ਅਤੇ ਸੰਚਾਰ ਟਰੇਲ ਜਾਂ ਰੂਟ ਉੱਤੇ ਨਿਰਭਰ ਕਰਦੇ ਹੋਏ ਨੈਵੀਗੇਸ਼ਨ ਐਪਸ ਦੇ ਨਾਲ ਇੱਕ ਨਕਸ਼ੇ ਜੀ ਪੀ ਐਸ ਡੀਵਾਈਸ ਜਾਂ ਸਮਾਰਟਫੋਨ ਲੈ ਕੇ ਜਾਣ ਨਾਲ ਅਣਜਾਣ ਰੂਟ ਨੂੰ ਨੈਵੀਗੇਟ ਕਰਨ ਅਤੇ ਕੋਰਸ 'ਤੇ ਰਹਿਣ ਵਿੱਚ ਮਦਦ ਮਿਲ ਸਕਦੀ ਹੈ ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਵਿੱਚ ਸੰਚਾਰ ਲਈ ਇੱਕ ਪੂਰੀ ਤਰ੍ਹਾਂ ਚਾਰਜ ਕੀਤੇ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੜਕ ਉੱਤੇ ਮੈਕੈਨੀਕਲ ਸਮੈਸਆਵਾਂ ਦੇ ਪ੍ਰਬੰਧਨ ਲਈ ਤਿਆਰੀ ਅਭਿਆਸ ਅਤੇ ਸਹੀ ਸਾਧਨਾ ਦੀ ਲੋੜ ਹੁੰਦੀ ਹੈ ਮੁੱਢਲੇ ਰੱਖ ਰਖਾਵ ਦੇ ਹੁਨਰ ਬਾਈਕ ਦੇ ਰੱਖ ਰਖਾਵ ਦੇ ਮੁੱਢਲੇ ਹੁਨਰ ਸਿੱਖਣਾ ਜਿਵੇਂ ਕਿ ਫਲੈਟ ਟਾਇਰ ਫਿਕਸ ਕਰਨਾ ਬਰੇਕਾਂ ਅਤੇ ਗੇਅਰਾਂ ਨੂੰ ਐਡਜਸਟ ਕਰਨਾ ਅਤੇ ਢਿੱਲੇ ਬੋਲਟ ਨੂੰ ਕਸਣਾ ਸੜਕ ਉੱਤੇ ਆਉਂਦੀਆਂ ਆਮ ਮਕੈਨੀਕਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ ਇੱਕ ਮੁਰੰਮਤ ਕਿੱਟ ਲੈ ਕੇ ਜਾਣਾ ਜ਼ਰੂਰੀ ਔਜ਼ਾਰ ਅਤੇ ਸਪੇਅਰ ਪਾਰਟਸ ਨਾਲ ਇੱਕ ਚੰਗੀ ਤਰ੍ਹਾਂ ਲੈਸ ਮੁਰੰਮਤ ਕਿੱਟ ਚੁੱਕਣਾ ਸਾਈਕਲ ਸਵਾਰਾਂ ਨੂੰ ਮਾਮੂਲੀ ਮਕੈਨੀਕਲ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸੜਕ ਤੋਂ ਵਾਪਿਸ ਜਾਣ ਲਈ ਅਸਥਾਈ ਮੁਰੰਮਤ ਕਰਨ ਦੀ ਇਜਾਜ਼ਤ ਦਿੰਦਾ ਹੈ ਅਭਿਆਸ ਅਤੇ ਤਿਆਰੀ ਘਰ ਵਿੱਚ ਸੜਕ ਕਿਨਾਰੇ ਮੁਰੰਮਤ ਦਾ ਅਭਿਆਸ ਕਰਨਾ ਆਪਣੇ ਆਪ ਨੂੰ ਬਾਇਕ ਦੇ ਭਾਗਾਂ ਤੋਂ ਜਾਣੂ ਕਰਵਾਉਣਾ ਅਤੇ ਉਹ ਕਿਵੇਂ ਕੰਮ ਕਰਦੇ ਹਨ ਸੜਕ 'ਤੇ ਮਕੈਨੀਕਲ ਸਮੱਸਿਆਵਾਂ ਦੇ ਪ੍ਰਬੰਧਨ ਵਿੱਚ ਵਿਸ਼ਵਾਸ ਅਤੇ ਕੁਸ਼ਲਤਾ ਵਿੱਚ ਸੁਧਾਰ ਕਰ ਸਕਦੇ ਹਨ ਇਹ ਜਾਣਨਾ ਕਿ ਮਦਦ ਕਦੋਂ ਲੈਣੀ ਹੈ ਵੱਡੀਆਂ ਮਕੈਨੀਕਲ ਅਸਫਲਤਾਵਾਂ ਜਾਂ ਮੁਰੰਮਤ ਕਰਨ ਦੀ ਸਮਰੱਥਾ ਤੋਂ ਬਾਹਰ ਆਉਂਦੀ ਹੈ ਸਮੱਸਿਆਵਾਂ ਦੇ ਮਾਮਲੇ ਵਿੱਚ